ਵੈਸੇ ਤਾਂ ਮੈਂ ਬਹੁਤ ਜਗ੍ਹਾ ਦੀ ਯਾਤਰਾ ਕੀਤੀ ਹੈਗੀ ਹੈ ਮੈਂ ਘੁੰਮਣ ਦਾ ਸ਼ੌਕੀਨ ਹਾਂ ਨਵੀਂ ਨਵੇਂ ਥਾਵਾਂ 'ਤੇ ਘੁੰਮਣਾ ਮੈਨੂੰ ਬੜਾ ਵਧੀਆ ਲੱਗਦਾ ਵੀ ਨਵਾਂ ਨਵੇਂ ਦੋਸਤਾਂ ਨਾਲ ਦੋਸਤ ਬਣਾਉਣਾ ਵੀ ਮੈਨੂੰ ਵਧੀਆ ਲੱਗਦਾ ਹੈਗਾ ਥੁ ਇਹਦੇ ਵਿੱਚੋਂ ਜਦੋਂ ਮੈਂ ਉੱਥੇ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਜਿਕਰ ਕਰਨ ਲੱਗਿਆ ਉਹਦੇ ਵਿੱਚ ਸੀਗਾ ਜਦੋਂ ਮੈਂ ਅਸੀਂ ਦਸ ਦੋ ਅੱਠ ਦਸ ਦੋਸਤ ਸੀਗੇ ਗੱਡੀ 'ਚ ਉੱਥੇ ਨੂੰ ਗਏ ਉਹ ਤੋਂ ਪਹਿਲ ਪਹਿਲਾਂ ਤਾਂ ਅਸੀਂ ਉੱਥੇ ਗੋਬਿੰਦ ਧਾਮ ਗਏ ਗੋਬਿੰਦ ਧਾਮ ਰਹੇ ਗੋਬਿੰਦ ਧਾਮ ਤੋਂ ਆਪਾਂ ਪੈਦਲ ਸਫ਼ਰ ਬਾਰ੍ਹਾਂ ਕਿਲੋਮੀਟਰ ਦਾ ਅੱਗੇ ਨੂੰ ਗੋਬਿੰਦ ਘਾਟ ਤੱਕ ਦਾ ਇੱਕ ਦਿਨ ਤੈਅ ਕੀਤਾ ਅਗਲੇ ਦਿਨ ਅਸੀਂ ਉੱਥੇ ਨੂੰ ਚਲੇ ਗਏ ਉੱਪਰ ਜਾਣਾ ਸੀਗਾ ਹੇਮਕੁੰਟ ਸਾਹਿਬ ਉੱਥੇ ਜਦੋਂ ਅਸੀਂ ਉੱਥੇ ਗਏ ਉੱਥੇ ਜਦੋਂ ਜਿਹੜਾ ਮੈਨੂੰ ਸਭ ਤੋਂ ਬੜਾ ਝਟਕਾ ਲੱਗਿਆ ਉੱਥੇ ਲੱਗਿਆ ਕਿ ਜਦੋਂ ਜਿਹੜੇ ਸਿੰਘ ਸੀਗੇ ਜਿਹੜੇ ਪਾਠੀ ਸਿੰਘ ਸੀਗੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਸੀਗੇ ਜਿਹੜੇ ਉਹਨਾਂ ਦੀ ਬੋਲੀ 'ਚ ਸੀਗਾ ਉਹਨਾਂ ਦੀ ਬੋਲੀ ਵਿੱਚ ਜਿਹੜਾ ਹੈਗਾ ਸੀਗਾ ਹਿੰਦੀ ਲਹਿਜਾ ਉਹ ਮਤਲਬ ਪ੍ਰਤੀਤ ਹੁੰਦਾ ਸੀਗਾ ਉਹ ਪੰਜਾਬੀ ਨਹੀਂ ਮਤਲਬ ਪ੍ਰੋਪਰ ਬੋਲ ਪਾਉਂਦੇ ਸੀਗੇ ਉਹ ਉਹ ਮੈਨੂੰ ਉਹਨਾਂ ਨੂੰ ਦੇਖ ਕੇ ਮਤਲਬ ਬੜਾ ਉਹ ਝਟਕਾ ਜਿਹਾ ਲੱਗਿਆ ਹੈਗਾ ਹੈ ਕਿਉਂਕਿ ਉੱਥੇ ਜਿਹੜੇ ਉਹਨਾਂ ਨੂੰ ਸਿੰਘ ਜਿਹੜੇ ਸਿੰਘ ਸੀਗੇ ਉਹ ਜਿਹੜੇ ਪ੍ਰੋਪਰ ਪੰਜਾਬੀ ਬੋਲਣੇ ਵਾਲੇ ਰੱਖਣੇ ਆਣੇ ਮਤਲਬ ਰੱਖਣੇ ਚਾਹੀਦੇ ਸੀਗੇ ਜੀ ਉਹ